ਸੰਗੀਤ ਉਤਸਵ ਦਾ ਦੇਖਣ ਦਾ ਮੇਰਾ ਬਹੁਤ ਮਨ ਸੀ ਹੁਣ ਮੈਨੂੰ ਪਤਾ ਲੱਗਿਆ ਕਿ ਸੰਗੀਤ ਉਤਸਵ ਵਾਲੀ ਡੇਟ ਫਿਕਸ ਹੋ ਗਈ ਹੈ ਹੁਣ ਆਪਣੇ ਦੋਸਤਾਂ ਨੂੰ ਆ ਦੱਸਿਆ ਕਿ ਆਪਾਂ ਇਨ੍ਹਾਂ ਦੀਆਂ ਟਿਕਟਾਂ ਬੁੱਕ ਕਰ ਲਈਏ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਦਿੱਕਤ ਨਾ ਆਏ ਹੁਣ ਫੋਨ ਕਰਕੇ ਅਸੀਂ ਪੁੱਛਾਂਗੇ ਫੋਨ ਕਰਕੇ ਟਿਕਟ ਆਪਣੀ ਬੁੱਕ ਕਰ ਲਵਾਂਗੇ ਤਾਂ ਸਾਡੀ ਟਿਕਟ ਸੁਰੱਖਿਅਤ ਹੋ ਜਾਏਗੀ